ਮੇਰੀ ਹੁਣ ਤੱਕ ਦੀ ਸਭ ਤੋਂ ਸੁੰਦਰ ਯਾਤਰਾ ਸ਼੍ਰੀ ਨੈਣਾਂ ਦੇਵੀ ਹਿਮਾਚਲ ਪ੍ਰਦੇਸ਼ ਵਿੱਚ ਕੀਤੇ ਮਾਤਾ ਰਾਣੀ ਦੇ ਦਰਸ਼ਨ ਹੈ ਇਸ ਵਿੱਚ ਮੈਂ ਬਹੁਤ ਹੀ ਮਜ਼ਾ ਮਜ਼ੇ ਕੀਤੇ ਇਹ ਯਾਤਰਾ ਮੇਰੀ ਸਭ ਤੋਂ ਪਸੰਦ ਯਾਤਰਾ ਰਹੀ ਹੈ ਅਸੀਂ ਸਵੇਰੇ ਨੌਂ ਕ ਤਕਰੀਬਨ ਨੌਂ ਕੁ ਵਜੇ ਦੇ ਟਾਈਮ ਨਾਲ ਦਰਸ਼ਨ ਲਈ ਚਲੇ ਗਏ ਅਤੇ ਸ਼ਾਮ ਸੂਰਜ ਡੁੱਬਣ ਤੱਕ ਅਸੀਂ ਸਭ ਆਪਣੇ ਘਰ ਆ ਗਏ ਇਹ ਯਾਤਰਾ ਮੇਰੇ ਲਈ ਬਹੁਤ ਹੀ ਅਨੰਦਾਇਕ ਡ ਯਾਤਰਾ ਰਹੀ ਹੈ ਇਸ ਵਿੱਚ ਮੈਨੂੰ ਇਤਿਹਾਸ ਬਾਰੇ ਵੀ ਬਹੁਤ ਜਾਣਕਾਰੀ ਮਿਲੀ ਹੈ